ਹਾਂਜੀ ਸ਼ਹਿਰ ਦੇ ਵਿੱਚ ਤਾਂ ਜਿੱਥੇ ਮਰਜ਼ੀ ਆਪਾਂ ਜਾ ਕੇ ਰਹਿ ਸਕਦੇ ਹਾਂ ਕਿਉਂਕਿ ਸ਼ਹਿਰ ਦੇ ਆਪਾਂ ਨੂੰ ਇਹੋ ਜਿਹੀ ਇਹੋ ਜਿਹੀਆਂ ਸਹੂਲਤਾਂ ਮਿਲਦੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਆਪਾਂ ਨੂੰ ਅੱਜ ਕੱਲ੍ਹ ਇੱਥੇ ਕਿਤੇ ਨਹੀਂ ਮਿਲਦੀਆਂ ਨੇ ਇੱਥੇ ਤਾਂ ਛੋਟੇ ਛੋਟੇ ਜਿਹੇ ਪਿੰਡ ਨੇ ਚਾਰ ਗਲੀਆਂ ਚਾਰ ਗਲੀਆਂ ਦੇ ਪਿੰਡ ਹੁੰਦੇ ਨੇ ਆਪਾਂ ਨੂੰ ਸ਼ਹਿਰ ਦੇ ਵਿੱਚ ਵੀ ਇੱਕ ਵਾਰੀ ਵੇਖਣਾ ਪਵੇਗਾ ਮਾਹੌਲ ਬੜਾ ਵੈਸੇ ਤਾਂ ਵਧੀਆ ਹੁੰਦਾ ਸਾਰੀਆਂ ਚੀਜ਼ਾਂ ਉੱਥੇ ਤਾਂ ਕ ਆਪਾਂ ਨੂੰ ਆਉਣਾ ਵੀ ਘਰ ਬੈਠੇ ਬਿਠਾਏ ਮਿਲ ਜਾਂਦੀਆਂ ਨੇ ਤੁਸੀਂ ਫੋਨ 'ਤੇ ਹਾਂ ਉੱਥੇ ਬਹੁਤ ਵਧੀਆ ਪਾਰਟੀ ਵਗੈਰਾ ਵਧੀਆ ਹੁੰਦੀਆਂ ਨੇ ਉੱਥੇ ਇੰਨੇ ਵਧੀਆ ਪੈਲੇਸ ਨੇ ਘੁੰਮਣ ਦੀਆਂ ਬੜੀਆਂ ਜਗ੍ਹਾ ਹੁੰਦੀਆਂ ਨੇ ਖਾਣਾ ਪੀਣਾ ਜੋ ਮਰਜ਼ੀ ਹੈ ਉੱਥੇ ਪਿੰਡਾਂ ਨਾਲੋਂ ਤਾਂ ਫਿਰ ਸ਼ਹਿਰ ਜ਼ਿਆਦਾ ਹੋਣ

ਹਾਂ ਪਿੰਡਾਂ ਦੇ ਵਿੱਚ ਤਾਂ ਉਹ ਚੀਜ਼ਾਂ ਨਹੀਂ ਮਿਲ ਸਕਦੀਆਂ ਜਿਹੜੀਆਂ ਸ਼ਹਿਰਾਂ 'ਚ ਸ਼ਹਿਰ ਦੇ ਵਿੱਚ ਤਾਂ ਫਿਰ ਵੱਡੇ ਵੱਡੇ ਸ਼ੋਰੂਮ ਬਣੇ ਹੁੰਦੇ ਨੇ ਵਧੀਆ ਵਧੀਆ ਚੀਜ਼ਾਂ ਇੱਥੇ ਮਿਲਦੀਆਂ ਨੇ ਪਰ ਪਿੰਡ ਦੇ ਵਿੱਚ ਤਾਂ ਉਹ ਗੱਲਾਂ ਆਪਾਂ ਨੂੰ ਕਿੱਥੇ ਮਿਲਦੀਆਂ ਨੇ ਠੀਕ ਹੈ ਸ਼ਹਿਰ ਦੇ ਵਿੱਚ ਚੱਲਦੀਆਂ ਨੇ ਹਾਂ ਅਤੇ ਪਿੰਡਾਂ ਵਾਲੇ ਬੱਚੇ ਹੁਣ ਸ਼ਹਿਰਾਂ 'ਚ ਹੀ ਪੜ੍ਹਨ ਜਾਂਦੇ ਨੇ ਦੂਰ ਦੂਰ ਦੇਖਦੇ ਹਾਂ ਕੋਈ ਚੰਡੀਗੜ੍ਹ ਪੜ੍ਹਦਾ ਪਿਆ ਕੋਈ ਲੁਧਿਆਣੇ ਪੜ੍ਹਨ ਜਾਂਦਾ ਪਿਆ ਕੋਈ ਪਟਿਆਲੇ ਪੜ੍ਹ ਰਿਹਾ ਜਾਂ ਵਧੀਆ ਸਕੂਲ ਦੇ ਵਿੱਚ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲ ਸਕਦੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਹੈਗੀਆਂ ਨੇ ਹਾਂ ਵਧੀਆ ਆਪਾਂ ਮੈਂ ਤਾਂ ਆਪ ਸੋਚਦਾ ਪਿਆ ਸੀ ਇੱਕ ਸ਼ਹਿਰ ਦੇ ਵਿੱਚ ਪਲਾਟ ਲ ਨਹੀਂ ਮੈਂ ਤਾਂ ਆਪ ਇੱਕ ਸ਼ਹਿਰ ਦੇ ਵਿੱਚ ਪਲਾਟ ਲੈ ਕੇ ਉੱਥੇ ਵਧੀਆ ਜਿਹਾ ਮਕਾਨ ਬਣਾ ਕੇ ਅਤੇ ਮੈਂ ਤਾਂ ਉੱਥੇ ਸ਼ਿਫਟ ਹੋਣ ਲੱਗਿਆਂ ਤਾਂ ਸੋਚਦਾ ਵੈਸੇ ਅਜੇ ਰਾਤੀਂ ਘਰ ਗੱਲ ਹੁੰਦੀ ਪਈ ਸੀ ਵੀ ਇੱਥੇ ਇੱਕ ਸ਼ਹਿਰ ਦੇ ਵਿੱਚ ਮਕਾਨ ਬਣਾਉਣਾ ਹਾਂ ਉੱਥੇ ਸ਼ਹਿਰ 'ਚ ਤਾਂ ਫਿਰ ਤੁਹਾਨੂੰ ਸਾਰਾ ਕੁਝ ਹੀ ਮਿਲੇਗਾ ਪਿੰਡਾਂ ਦੇ ਕੀ ਹੈ ਪਿੰਡਾਂ ਦਾ ਤਾਂ ਛੋਟਾ ਜਿਹਾ ਇੱਕ ਏਰੀਆ ਹੁੰਦਾ ਬੋਲਣਾ ਕੋਈ ਬੰਦਾ ਉੱਥੇ ਰਹਿੰਦਾ ਓਨੀ ਕੁ ਚੀਜ਼ ਮਿਲਦੀ ਮਤਲਬ ਬੰਦਾ ਉਨੇ ਕੁ ਏਰੀਏ 'ਚ ਰਹਿ ਜਾਂਦਾ ਸਾਰਾ ਕੁਝ ਬੰਦਾ ਸ਼ਹਿਰ ਦੇ ਵਿੱਚ ਤਾਂ ਬਹੁਤ ਵਧੀਆ ਇਹ ਕੁਝ ਸਾਰਾ ਕੁਛ ਆਪਾਂ ਤਾਂ ਉੱਥੇ ਲੈਣਾ ਉਹ ਤਾਂ ਮੈਂ ਤੇਰੇ ਵਾਸਤੇ ਇੱਕ ਹੋਰ ਖਰੀਦ ਦੇਵਾਂਗੇ ਹਾਂ ਠੀਕ ਹੈ ਜੀ